ਪੰਜਾਬ ਦੇ ਵਿੱਚ ਮਾਨਸਿਕ ਸਿਹਤ ਦੇ ਬਹੁਤ ਸਾਰੇ ਸਰੋਤ ਹਨ ਜਿਵੇਂ ਕਿ ਆਪਣੀਆਂ ਦਵਾਈਆਂ ਇਲਾਜ ਕਰਾਉਣਾ ਕਿਸੇ ਵੀ ਚੀਜ਼ ਦਾ ਇਲਾਜ ਕਰਾਉਣਾ ਜਾਂ ਹੋਰ ਕਰਾਉਣਾ ਬਹੁਤ ਹੀ ਸੌਖਾ ਹੈ ਅਤੇ ਇਹਨਾਂ ਦੇ ਬਾਰੇ ਸਲਾਹ ਲੈਣੀ ਆਪਣੇ ਮੁਹੱਲਿਆਂ ਦੇ ਵਿੱਚ ਜੋ ਕਲੀਨਿਕ ਹੁੰਦੇ ਹਨ ਉਹਨਾਂ ਤੋਂ ਸਲਾਹ ਲੇਤੀ ਜਾਵੇ ਜਾਂ ਫਿਰ ਉਹਨਾਂ ਦੇ ਆਪਾਂ ਬਾਹਰ ਉਹਨਾਂ ਦੀ ਸਲਾਹ ਦੇ ਨਾਲ ਬਾਹਰ ਜਾ ਕੇ ਜਿਵੇਂ ਆਪਣੇ ਬਾਹਰਲੇ ਜੋ ਨੇੜੇ ਸ਼ਹਿਰ ਲੱਗਦਾ ਉਹਨਾਂ ਦੇ ਇਲਾਜ ਕਰਾਇਆ ਜਾਵੇ ਜਾਂ ਆਪਣੀ ਦਵਾਈ ਵਧੀਆ ਮੈਡੀਕਲ ਜਾਂ ਡੋਕਟਰ ਤੋਂ ਲੈ ਕੇ ਖਾਧੀ ਜਾਵੇ ਇਹ ਸਰੀਰਕ ਸਰੋਤ ਹਨ ਅਤੇ

ਸਰੀਰਕ ਅਤੇ ਮਾਨਸਿਕ ਸਿਹਤ ਦੀ ਸੰਭਾਲ ਵਾਸਤੇ ਬਹੁਤ ਜ਼ਰੂਰੀ ਹਨ ਇਹ ਸੰਭਾਲ ਬਹੁਤ ਜ਼ਰੂਰੀ ਆ ਕਰਨੀ ਅਤੇ ਖਾਣ ਦੀਆਂ ਚੀਜ਼ਾਂ ਆਪਣੀਆਂ ਪਾਣੀ ਹੋਰ ਸ਼ੁੱਧ ਵਾਤਾਵਰਨ ਜ਼ਰੂਰੀ ਹੈ ਅਤੇ ਪੰਜਾਬ ਦੇ ਵਿੱਚ ਮਾਨਸਿਕ ਸਿਹਤ ਦੇ ਇਹ ਜਿਹੜੇ ਸਰੋਤ ਹਨ ਪਾਣੀ ਹਵਾ ਦਰਖਤ ਹੋਰ ਬਹੁਤ ਕੁਛ ਹੈ ਜੋ ਕਿ ਆਪਣੀ ਮਾਨਸਿਕ ਸਿਹਤ ਦੇ ਸਰੋਤ ਲਈ ਬਹੁਤ ਹੀ ਸਿਹਤਮੰਦ ਹੁੰਦੇ ਹਨ ਅਤੇ ਸਿਹਤ ਦੀ ਸੰਭਾਲ ਲਈ ਵੀ ਜ਼ਰੂਰੀ ਹੈ